ਅਗਰ ਗੱਲ ਕਰੀ ਜਾਵੇ ਤਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜੇ ਸੈਲਾਨੀ ਹਨ ਉਹ ਇੰਨੇ ਨਹੀਂ ਆਉਂਦੇ ਹਨ ਤਾਂ ਇਸਦੇ ਵਿ ਤਾਂ ਸਾਡੇ ਜਿਹੜੇ ਆਂਢ ਗੁਆਂਢ ਜਿਹੜਾ ਜਗ੍ਹਾ ਹੈ ਉਸਦੇ ਵਿੱਚ ਕੋਈ ਇਸ ਤਰੀਕੇ ਦੇ ਤੁਸੀਂ ਕਹਿ ਸਕੋਂ ਹੋਮ ਸਟੇਅ ਹਨ ਜਿਹੜੇ ਕੇ ਉਹ ਨਹੀਂ ਬਣੇ ਹ ਬਣੇ ਹੋਏ ਹਨ ਪਰ ਹਾਂ ਮੈਂ ਮੇਰੇ ਮੈਂ ਮੇਰਾ ਇਹ ਤਜਰਬਾ ਰਿਹਾ ਹੈ ਕਿ ਕਿਉਂਕਿ ਮੈਂ ਬਹੁਤ ਕੰਮ ਦੇ ਅਤੇ ਕੁਛ ਪੜ੍ਹਾਈ ਦੇ ਸਿਲਸਿਲੇ ਦੇ ਵਿੱਚ ਬਹੁਤ ਸਫ਼ਰ ਇੱਧਰ ਉੱਧਰ ਬਹੁਤ ਸਫ਼ਰ ਕੀਤਾ ਹੈ ਤਾਂ ਜਿਸ ਦੇ ਵਿੱਚ ਮੈਂ ਹੋਮ ਸਟੇਅ ਦੇ ਵਿੱਚ ਵੀ ਰਿਹਾ ਹਾਂ ਤਾਂ ਉਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੈਂ ਮਤਲਬ ਆਪਣੇ ਤਜਰਬੇ ਦੇ ਹਿਸਾਬ ਨਾਲ ਦੱਸ ਸਕਦਾ ਹਾਂ ਕਿ ਵੀ ਮਾਲਕ ਨੂੰ ਕੀ ਜੋ ਹੈ ਮੁਸ਼ਕਲ ਆ ਸਕਦੀ ਹੈ ਉਹ ਇਹ ਹੈ ਕਿ ਜੋ ਕਿ ਕਿਉਂਕਿ ਘਰ ਹੈ ਤਾਂ ਉੱਥੇ ਜਦੋਂ ਕਿਸੇ ਨੇ ਔ ਆਉਣਾ ਹੈ ਤਾਂ ਉਸਨੂੰ ਉਸਦੇ ਜਿਹੜੀਆਂ ਸ ਕੁਛ ਵੀ ਉੱਥੇ ਰਹਿਣ ਸਹਿਣ ਦੀਆਂ ਜਿਹੜੀਆਂ ਵੀ ਫਸਿਲਟੀਜ ਹਨ ਉਹ ਦੇਣੀਆਂ ਉਹ ਵਧੀਆ ਤਰੀਕੇ ਨਾਲ ਅਤੇ ਇਸ ਤੋਂ ਬਾਅਦ ਉਸ ਚੀਜ਼ ਨੂੰ ਉਹ ਲੋਕਾਂ ਨੇ ਸੈਲਾਨੀਆਂ ਨੇ ਵੀ ਉਸ ਨੂੰ ਵਧੀਆ ਤਰੀਕੇ ਨਾਲ ਰੱਖਣਾ ਉਹ ਬਹੁਤ ਵੱਡੀ ਚੁਣੌਤੀ ਹੈ ਜੋ ਕਿ ਰਹਿੰਦੀ ਹੈ ਅਤੇ ਸਭ ਤੋਂ ਵੱਡਾ ਹੈ ਆਕਰਸ਼ਣ ਕੀ ਤੁਸੀਂ ਆਪਣੇ ਘਰ ਦੇ ਵਿੱਚ ਕੀ ਆਕਰਸ਼ਣ ਪੈਦਾ ਕਰ ਸਕਦੇ ਹੋ ਤਾਂ ਕੇ ਸਾਡੇ ਸੈਲਾਨੀ ਹਨ ਉਹ ਆਉਣ ਅਤੇ ਉੱਥੇ ਰਹਿ ਕੇ ਬਹੁਤ ਮਜ਼ੇ ਕਰਨ ਜੀ